ਮੀਡੀਆ ਪੰਜਾਬੀ ਭਾਸ਼ਾ ਨੂੰ ਪਰਮੋਟ ਕਰਨ ਵਿੱਚ ਬਹੁਤ ਮਦਦਗਾਰ ਹੁੰਦੀ ਹੈ ਅੱਜ ਦੇ ਟਾਈਮ ਵਿੱਚ ਮੀਡੀਆ ਇੱਕ ਅਜਿਹਾ ਪਲੈਟਫੋਮ ਹੈ ਜਿਹਦੇ ਨਾਲ ਗਰੀਬ ਵਿਅਕਤੀ ਵੀ ਆਪਣੀ ਅਵਾਜ਼ ਸਰਕਾਰ ਤੱਕ ਪਹੁੰਚਾ ਹੀ ਦਿੰਦਾ ਅਤੇ ਜਿਹੜੀ ਪੰਜਾਬੀ ਭਾਸਾ ਸਾਨੂੰ ਅਸੀਂ ਮਤਲਬ ਦੂਜੇ ਲੋਕ ਪੜ੍ਹ ਵੀ ਸਕਦੇ ਹੈ ਅਤੇ ਸੁਣ ਵੀ ਸਕਦੇ ਹੈ ਅਤੇ ਸਰਕਾਰ ਵੀ ਬਹੁਤ ਯਤਨ ਕਰ ਰਿਹਾ ਹੈ ਮਤਲਬ ਪੰਜਾਬੀ ਭਾਸ਼ਾ ਨੂੰ ਸਾਂਭ ਕੇ ਰੱਖਣ ਲਈ ਅਤੇ ਮੀਡੀਆ ਇੱਕ ਅਹਿਮ ਰੋਲ ਮੰਨਦੀ ਹੈ ਅਤੇ ਅਸੀਂ ਵੀ ਪੰਜਾਬੀ ਭਾਸ਼ਾ ਤੇ ਪੜ੍ਹੇ ਹੋਏ ਹੈ ਅਤੇ ਸਾਨੂੰ ਵੀ ਪੰਜਾਬੀ ਬਹੁਤ ਵਧੀਆ ਲੱਗਦੀ ਹੈ ਅਤੇ ਅਸੀਂ ਪੰਜਾਬੀ ਨਿਊਜ਼ ਵੀ ਸੁਣਦੇ ਹੈ ਅਤੇ ਪੰਜਾਬੀ ਗਾਣੇ ਵੀ ਸੁਣਦੇ ਹੈ ਅਤੇ ਮਤਲਬ ਵਧੀਆ ਹੈ ਪੰਜਾਬੀ ਅਤੇ ਮਤਲਬ ਇੱਕ ਲੈਗੁਏਜ਼ ਅਲੱਗ ਹੋ ਜਾਂਦੀ ਹੈ ਮਤਲਬ ਮਤਲਬ ਸਿੱਖਣ ਨੂੰ ਮਿਲ ਜਾਂਦੀ ਹੈ ਅਤੇ ਮਤਲਬ ਬਹੁਤ ਹੀ ਵਧੀਆ ਹੈ ਪੰਜਾਬੀ ਅਤੇ ਮੈਂ ਤਾਂ ਕਹਿ ਮੈਂ ਤਾਂ ਆਪਣੇ ਮਤਲਬ ਜਿਹੜੇ ਇਸ ਘਰ ਦੇ ਲੋਕ ਹੈ ਉਹਨਾਂ ਨੂੰ ਵੀ ਸਿਖਾਉਂਦੀ ਹਾਂ ਕਿਉਂਕਿ ਉਹ ਇੱਥੇ ਦੇ ਪੜ੍ਹੇ ਲਿਖੇ ਨਹੀਂ ਹੈ ਅਤੇ ਇਸ ਕਰਕੇ